ਬਾਈਕਿੰਗ ਕਮਿਊਨਿਟੀ ਵਿੱਚ ਸ਼ਾਮਿਲ ਹੋਣਾ ਬਾਈਕ ਕਮਿਊਨਿਟੀ ਦੇ ਨਿਰਭਰ ਕਰਦਾ ਹੈ ਕੁਝ ਬਾਈਕ ਕਮਿਊਨਿਟੀ ਸਿੱਧਾ ਮੀਟਿੰਗ ਕਰਕੇ ਹੀ ਉਸ ਵਿੱਚ ਸ਼ਾਮਿਲ ਕਰ ਦਿੰਦੇ ਹਨ ਅਤੇ ਕੁਝ ਬਾਈਕਿੰਗ ਕਮਿਊਨਿਟੀ ਉਸ ਲਈ ਕੁਝ ਕੀ ਚਾਰਜਸ ਮੰਗਦੇ ਹਨ ਇਸ ਲਈ ਬਾਇਕਿੰਗ ਕਮਿਊਨਟੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਉਸ ਕਮਿਊਨਿਟੀ ਬਾਰੇ ਜਾਣਨਾ ਉਸ ਕਮਿਊਨਿਟੀ ਵਿੱਚ ਕਿਸ ਤਰ੍ਹਾਂ ਦੇ ਲੋਕ ਹਨ ਅਤੇ ਉਹ ਕਮਿਊਨਿਟੀ 'ਚ ਸ਼ਾਮਿਲ ਹੋ ਕਿ ਮੈਨੂੰ ਕੀ ਲਾਭ ਹੋ ਸਕਦਾ ਹੈ ਉਸ ਅਕੋਰਡਿੰਗ ਮੈਂ ਕਮਿਊਨਿਟੀ ਵਿੱਚ ਸ਼ਾਮਿਲ ਹੋਣਾ ਚਾਹਵਾਂਗਾ ਹਾਂ ਮੈਂ ਇਕੱਲਾ ਵੀ ਬਾਈਕਿੰਗ ਕਰਨਾ ਚਾਹਵਾਂਗਾ ਕਿਉਂਕਿ ਬਾਈਕ ਚਲਾਉਣਾ ਮੇਰਾ ਸ਼ੌਂਕ ਹੈ ਇਸ ਕਰਕੇ ਮੈਂ ਬਾਈਕ ਇਕੱਲੇ ਬਾਈਕ ਚਲਾਉਣ ਨੂੰ ਤਰਜੀਹ ਦਿੰਦਾ ਹਾਂ